ਹਾਂਜੀ ਮੈਂ ਗਾਹਕਾਂ ਨੂੰ ਗਾਹਕਾਂ ਤੋਂ ਮੈਨੂੰ ਬਹੁਤ ਚੰਗਾ ਰਿਸਪਾਂਸ ਮਿਲਿਆ ਹੈ ਉਹਨਾਂ ਨੂੰ ਮੇਰੇ ਬਣਾਏ ਹੋਏ ਉੱਨ ਦੇ ਕੱਪੜੇ ਬਹੁਤ ਪਸੰਦ ਆਉਂਦੇ ਹਨ ਮੈਂ ਜੋ ਵੀ ਉਹਨਾਂ ਨੂੰ ਬਣਾ ਕੇ ਦਿੱਤਾ ਜਿਵੇਂ ਕਿ ਸਵਾਟਰ ਕੋਟੀਆਂ ਉਹ ਕਹਿੰਦੇ ਹਨ ਕਿ ਤੇਰੀ ਬੁਣਾਈ ਸਿਲਾਈ ਬਹੁਤ ਚੰਗੀ ਹੈ ਜੋ ਵੀ ਮੈਂ ਉਹਨਾਂ ਨੂੰ ਬਣਾ ਕੇ ਦਿੰਦੀ ਹਾਂ ਉਹ ਬਹੁਤ ਪਸੰਦ ਕਰਦੇ ਹਨ ਉਹਨਾਂ ਨੂੰ ਮੇਰੇ ਹੱਥ ਦੇ ਬਣੇ ਹੋਏ ਡਿਜ਼ਾਇਨ ਜਿਵੇਂ ਕਿ ਸਵਾਟਰਾਂ ਉੱਤੇ ਫਲਾਵਰ ਸਿਰ੍ਹਾਣਿਆਂ ਉੱਤੇ ਫਲਾਵਰ ਰੁਮਾਲ ਕੱਢੇ ਹੋਏ ਜਿਹਨਾਂ 'ਤੇ ਬੱਤਖਾਂ ਮੋਰ ਚਾਦਰਾਂ 'ਤੇ ਡਿਜ਼ਾਇਨ ਉਹ ਉਹਨਾਂ ਨੂੰ ਬਹੁਤ ਪਸੰਦ ਆਉਂਦੇ ਹਨ ਹਾਂ ਮੈਂ ਆਪਣੀ ਇੱਕ ਸਹੇਲੀ ਪੂਜਾ ਨੂੰ ਆਪਣੀ ਬਣੀ ਹੱਥ ਦੀ ਬਣੀ ਹੋਈ ਚਾਦਰ ਗਿਫਟ ਕੀਤੀ ਸੀ ਉਸ ਦੀ ਮੈਰਿਜ 'ਤੇ ਜੋ ਕਿ ਉਸਨੂੰ ਬਹੁਤ ਪਸੰਦ ਆਈ ਅਤੇ ਉਸਦੇ ਸਹੁਰੇ ਪਰਿਵਾਰ ਵਾਲਿਆਂ ਨੇ ਵੀ ਇਸਦੀ ਬਹੁਤ ਤਾਰੀਫ ਕੀਤੀ ਉਹਨਾਂ ਨੇ ਕਿਹਾ ਕਿ ਤੇਰੀ ਫਰੈਂਡ ਜੋ ਵੀ ਕੱਪੜੇ ਬਣਾਉਂਦੀ ਹੈ ਬਹੁਤ ਵਧੀਆ ਬਣਾਉਂਦੀ ਹੈ ਸਾਨੂੰ ਇੱਕ ਦੋ ਚਾਦਰਾਂ ਹੋਰ ਬਣਵਾ ਕੇ ਦਈਂ ਕਿਉਂਕਿ ਸਵਾਟਰਾਂ ਦੇ ਨਾਲ ਜੋ ਵੀ ਚੀਜ਼ ਬਣਦੀ ਹੈ ਉਸ 'ਤੇ ਸੋਹਣੀ ਸੋਹਣੀ ਬੂਟੀ ਪਾਈ ਹੋਵੇ ਤਾਂ ਹੋਰ ਵੀ ਬਹੁਤ ਸੋਹਣੀ ਲੱਗਦੀ ਹੈ ਜਿਵੇਂ ਕਿ ਸਰੱਘ ਕੁੜੀਆਂ ਦੇ ਜੋ ਜੀਨ ਨਾਲ ਪਾਏ ਜਾਂਦੇ ਹਨ ਉਹ ਤਾਂ ਬਹੁਤ ਹੀ ਸੋਹਣੇ ਬਣਦੇ ਹਨ ਮੈਂ ਜਿਸ ਨੂੰ ਵੀ ਬਣਾ ਕੇ ਦਿੰਦੀ ਹਾਂ ਉਹ ਆ ਕੇ ਇਹੀ ਬੋਲਦਾ ਹੈ ਕਿ ਅਸੀਂ ਤੁਹਾਨੂੰ ਹੋਰ ਓਰਡਰ ਦੇਣਾ ਚਾਹੁੰਦੇ ਹਾਂ ਤੁਸੀਂ ਪਲੀਜ਼ ਜਲਦੀ ਬਣਾ ਕੇ ਦੇ ਦਿਓ ਮੈਂ ਜੋ ਵੀ ਚੀਜ਼ ਬਣਵਾਉਂਦੀ ਬਣਾਉਂਦੀ ਹਾਂ ਉਸ ਤੋਂ ਮੈਨੂੰ ਬਹੁਤ ਹੀ ਚੰਗਾ ਰਿਸਪੋਂਸ ਆਉਂਦਾ ਹੈ ਫੀਡਬੈਕ ਆਉਂਦਾ ਮਿਲਦਾ ਹੈ